ਮੈਂ ਕਦੇ ਵੀ ਇੱਦਾਂ ਦੇ ਅੰਤਰਰਾਸ਼ਟਰੀ ਰਾਜ ਰਾਸ਼ਟਰੀ ਪੱਧਰ 'ਤੇ ਫੋਟੋਗ੍ਰਾਫੀ 'ਚ ਕੋਈ ਮੁਕਾਬਲਾ ਨਹੀਂ ਲਿਆ ਅਤੇ ਨਾ ਹੀ ਹੁਣ ਮੇਰੇ ਕੋਲ ਇਸ ਤਰ੍ਹਾਂ ਦਾ ਕੋਈ ਟਾਈਮ ਹੈ ਹਾਂ ਜੇ ਮੈਂ ਜੇ ਨਹੀਂ ਤਾਂ ਹਿੱਸਾ ਨਹੀਂ ਲੈਣਾ ਵੀ ਨਹੀਂ ਚਾਹੁੰਦੀ ਕਿਉਂਕਿ ਹੁਣ ਮੈਨੂੰ ਕੋਈ ਇਹਦਾ ਸ਼ੌਕ ਨਹੀਂ ਫੋਟੋਗ੍ਰਾਫੀ ਦਾ ਸ਼ੌਕ ਹੈ ਬਟ ਇਹਦੇ ਵਿੱਚ ਕੋਈ ਇੱਦਾਂ ਦਾ ਮੈਨੂੰ ਉਹਦੇ ਵਿੱਚ ਹਿੱਸਾ ਲੈਣਾ ਕੋਈ ਇੰਨਾ ਪਸੰਦ ਨਹੀਂ ਹੈ